ਉਣੱਤੀ ਨਵੰਬਰ ਦੋ ਹਜ਼ਾਰ ਛੇ ਬਾਈ ਜਨਵਰੀ ਦੋ ਹਜ਼ਾਰ ਸੋਲਾਂ ਇੱਕ ਅਗਸਤ ਉੱਨੀ ਸੋ ਸਤੱਤਰ ਪੰਜ ਜੁਲਾਈ ਉੱਨੀ ਸੋ ਸਤੱਤਰ ਪੰਦਰਾਂ ਅਗਸਤ ਉੱਨੀ ਸੋ ਸੰਤਾਲੀ